ਵੀਰ ਜੀ ਮਨਾਲੀ ਜਾਣ ਵਾਸਤੇ ਗੱਡੀ ਬੁੱਕ ਕਰਨੀ ਹੈ ਮੈਨੂੰ ਇਹ ਦੱਸੋ ਪਰ ਕਿਲੋਮੀਟਰ ਤੁਸੀਂ ਕੀ ਲਉਂਗੇ ਟੌਲ ਦਾ ਤੁਹਾਡਾ ਕੀ ਖਰਚਾ ਹੋਏਗਾ ਅਤੇ ਪਾਰਕਿੰਗ ਦਾ ਕੀ ਹਿਸਾਬ ਕਿਤਾਬ ਹੋਏਗਾ ਚਾਰ ਰਾਤਾਂ ਵਾਸਤੇ ਸਾਨੂੰ ਗੱਡੀ ਚਾਹੀਦੀ ਹੈ ਔਰ ਅਸੀਂ ਤਿੰਨ ਜਾਣੇ ਹੋਵਾਂਗੇ ਸਾਨੂੰ ਗੱਡੀ ਬੜੀ ਚਾਹੀਦੀ ਹੈ ਜਿਸ ਤਰ੍ਹਾਂ ਇਨੋਵਾ ਹੋ ਗਈ ਆਰਟੀਕਾ ਹੋ ਗਈ ਉੱਚੀ ਗੱਡੀ ਛੋਟੀ ਗੱਡੀ ਨਹੀ ਲੈ ਕੇ ਜਾਣੀ ਔਰ ਡਰਾਇਵਰ ਦਾ ਤੁਹਾਡੇ ਦਾ ਰਾਤ ਦਾ ਕੀ ਹਿਸਾਬ ਕਿਤਾਬ ਹੋਏਗਾ ਔਰ ਕੋਈ ਫ਼ਾਲਤੂ ਖਰਚਾ ਸਾਡੇ 'ਤੇ ਜੋ ਵੀ ਪੈਣਾ ਉਹ ਸਾਰਾ ਸਾਨੂੰ ਚੰਗੀ ਤਰ੍ਹਾਂ ਕਲੀਅਰ ਕਰ ਦਿਓ